ਗੇਮਿੰਗ ਨੂੰ ਅਸੀਂ ਪੰਜਾਬੀ ਵਿੱਚ ਖੇਡਾਂ ਵੀ ਕਹਿੰਦੇ ਹਾਂ ਖੇਡਾਂ ਦੋ ਪ੍ਰਮੁੱਖ ਤਰ੍ਹਾਂ ਨਾਲ ਖੇਡੀਆਂ ਜਾਂਦੀਆਂ ਹਨ ਮੈਦਾਨ ਵਿੱਚ ਖੇਡੀਆਂ ਜਾਣ ਵਾਲੀਆਂ ਖੇਡਾਂ ਉਹਨਾਂ ਨੂੰ ਅਸੀਂ ਆਊਟਡੋਰ ਗੇਮਸ ਵੀ ਕਹਿੰਦੇ ਹਾਂ ਅਤੇ ਬੈਠ ਕੇ ਖੇਡੀਆਂ ਜਾਣ ਵਾਲੀਆਂ ਖੇਡਾਂ ਉਹਨਾਂ ਨੂੰ ਅਸੀਂ ਇੰਨਡੋਰਸ ਗੇਮਸ ਵੀ ਕਹਿੰਦੇ ਹਾਂ ਇੰਨਡੋਰ ਗੇਮ ਜਿਵੇਂ ਕਿ ਕੈਰਮ ਬੋਰਡ ਚੈਸ ਸੱਪ ਸਿਡੀ ਲੂਡੋ ਆਦਿ ਬੱਚੇ ਅੱਜ ਕੱਲ੍ਹ ਨਵੀਨ ਖੇਡਾਂ ਵੀ ਅੰਦਰ ਬੈਠਣ ਦੀਆਂ ਖੇਡਾਂ ਖੇਡਦਾਂ ਜਿਵੇਂ ਮਨੋਪਲੀ ਲੂਡੋ ਜੈਂਗਾ ਆਦਿ ਆਊਟਡੋਰ ਗੇਮਸ ਵਿਚ ਬਾਹਰ ਖੇਡੀਆਂ ਜਾਣ ਵਾਲੀਆਂ ਖੇਡਾਂ ਵਿੱਚ ਫੁੱਟਬੋਲ ਵੋਲੀਬੋਲ ਆਦਿ ਆ ਜਾਂਦੀਆਂ ਹਨ ਅੱਜ ਕੱਲ੍ਹ ਟੈਕਨੋਲਜੀ ਦੇ ਵਧਣ ਨਾਲ ਕੰਪਿਊਟਰ ਅਤੇ ਲੈਪਟਾਪ ਜਾਂ ਫੋਨ 'ਤੇ ਖੇਡੀਆਂ ਜਾਣ ਵਾਲੀਆਂ ਖੇਡਾਂ ਦਾ ਵੀ ਬਹੁਤ ਰੁਝਾਨ ਵੱਧ ਗਿਆ ਹੈ ਇਹ ਖੇਡਾਂ ਵੀ ਦੋ ਤਰ੍ਹਾਂ ਦੀਆਂ ਹੁੰਦੀਆਂ ਇੱਕ ਔਫਲਾਈਨ ਅਤੇ ਇੱਕ ਔਨਲਾਈਨ ਔਫਲਾਈਨ ਦਾ ਮਤਲਬ ਇੰਟਰਨੈਟ ਦੀ ਵਰਤੋਂ ਕਿਤੇ ਬਿਨਾਂ ਖੇਡੀਆਂ ਜਾਣ ਵਾਲੀਆਂ ਖੇਡਾਂ ਉਹ ਕੰਪਿਊਟਰ ਦਾ ਇੰਸਟਾਲ ਕਰਕੇ ਖੇਡੀਆਂ ਜਾਂਦੀਆਂ ਹਨ ਜਿਵੇਂ ਕਿ ਨੀਡ ਫੋਰ ਸਪੀਡ ਕਾਰ ਰੇਸਿੰਗ ਐਂਗਰੀ ਵਰਡ ਕੈਂਡੀ ਕ੍ਰੈਸ ਐਕਸੈਕਟਰਾ ਆਦਿ ਔਨਲਾਈਨ ਜਿਵੇਂ ਕਿ ਇੰਟਰਨੈਟ ਦੀ ਵਰਤੋਂ ਕਰਕੇ ਲਾਈਵ ਇੱਕ ਦੂਜੇ ਨਾਲ ਖੇਡੇ ਜਾਣ ਵਾਲੀਆਂ ਖੇਡਾਂ ਜਿਵੇਂ ਕਿ ਰੋਬਲੋਕਸ ਕੈਸ਼ ਆਫ ਕਲੈਨਸ ਮਾਇਨ ਕਰਾਫਟ ਮੈਂਕਰੇਨਾ ਫਰੀ ਫਾਇਰ ਪਬ ਜੀ ਆਦਿ ਔਨਲਾਈਨ ਗੇਮਾਂ ਦੇ ਕਾਰਨ ਇੱਕ ਤਾਂ ਗੇਮਿੰਗ ਗੇਮਿੰਗ ਉਦਯੋਗ ਨੂੰ ਜਾਂ ਗੇਮਿੰਗ ਕੰਪਨੀਆਂ ਨੂੰ ਬਹੁਤ ਫਾਇਦਾ ਹੁੰਦਾ ਹੈ ਉੱਥੇ ਹੀ ਅੱਜ ਕੱਲ੍ਹ ਬਹੁਤ ਸਾਰੇ ਬੱਚੇ ਦੇ ਵੱਡੇ ਵੀ ਜਿਹੜੀਆਂ ਔਨਲਾਈਨ ਗੇਮਾਂ ਖੇਡਣ ਲੱਗ ਪਏ ਹਨ ਉਸ ਦੇ ਨਾਲ ਟਾਈਮ ਵੀ ਬਹੁਤ ਖਰਾਬ ਹੁੰਦਾ ਹੈ ਕਿਉਂਕਿ ਇਹ ਗੇਮਾਂ ਜਿਹੜੀਆਂ ਹਨ ਉਹ ਇੱਕ ਆਦਤ ਅਡਿਕਸ਼ਨ ਦੀ ਤਰ੍ਹਾਂ ਬਣ ਜਾਂਦੀ ਹੈ ਅਤੇ ਔਨਲਾਈਨ ਗੇਮਾਂ ਵਿੱਚ ਖੇਡਣ ਦਾ ਟਾਈਮ ਦਾ ਪਤਾ ਵੀ ਨਹੀਂ ਲੱਗਦਾ ਜ਼ਿਆਦਾ ਔਨਲਾਈਨ ਗੇਮਾਂ ਖੇਡਣ ਨਾਲ ਸਾਡੀਆਂ ਅੱਖਾਂ 'ਤੇ ਵੀ ਅਸਰ ਪੈਂਦਾ ਹੈ ਕਿਉਂਕਿ ਸਕਰੀਨ ਟਾਈਮ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਅਤੇ ਔਨਲਾਈਨ ਗੇਮਾਂ ਦੀਆਂ ਕਈ ਘਟਨਾਵਾਂ ਵੀ ਕਈ ਵਾਰੀ ਸਾਡੇ ਸਾਹਮਣੇ ਆਈਆਂ ਹਨ ਖੇਡਾਂ ਤਾਂ ਸਾਡੀ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਲਈ ਬਣੀਆਂ ਸਨ ਪਰ ਅੱਜ ਕੱਲ੍ਹ ਦੀਆਂ ਖੇਡਾਂ ਗਲਤ ਤਰੀਕੇ ਨਾਲ ਸ਼ਰਤਾ ਗੈਮਲੀਆਂ ਲੜਾਈ ਦਾ ਕਾਰਨ ਵੀ ਬਣ ਜਾਂਦੀਆਂ ਹਨ ਪਿਛਲੇ ਸਮਿਆਂ ਵਿੱਚ ਖੇਡੀਆਂ ਜਾਣ ਦੀਆਂ ਖੇਡਾਂ ਤਾਂ ਸਾਡੇ ਸਰੀਰਕ ਪੱਖੋਂ ਮਾਨਸਿਕ ਪੱਖੋਂ ਬਹੁਤ ਵਿਕਾਸ ਕਰਦੀਆਂ ਸਨ ਪਰ ਹੁਣ ਕਈ ਔਨਲਾਈਨ ਗੇਮਾਂ ਦੇ ਕਾਰਨ ਟਾਈਮ ਖਰਾਬ ਮਾਨਸਿਕ ਤਨਾਵ ਆਦਿ ਵੀ ਕਾਰਨ ਬਣ ਜਾਂਦਾ ਹੈ ਇਸ ਲਈ ਸਾਨੂੰ ਇਸ ਤਰਾਂ ਦੀਆਂ ਖੇਡੀਆਂ ਖੇਡਾਂ ਖੇਡਣੀਆਂ ਚਾਹੀਦੀਆਂ ਹਨ ਜਿਹੜੀਆਂ ਕਿ ਸਾਡੇ ਸਰੀਰਕ ਅਤੇ ਮਾਨਸਿਕ ਕਸਰਤ ਨਾਲ ਸਾਡੇ ਸਰੀਰਕ ਅਤੇ ਮਾਨਸਿਕ ਵਿਕਾ ਮਾਨਸਿਕ ਨੂੰ ਤੰਦਰੁਸਤ ਰੱਖਣ ਵਿੱਚ ਸਹਾਈ ਹੋਣ